ਸਤਿ ਸ਼੍ਰੀ ਅਕਾਲ ਸਰ ਤੁਸੀਂ ਖਾਲਸਾ ਢਾਬੇ ਤੋਂ ਗੱਲ ਕਰ ਰਹੇ ਹੋ ਮੇਰਾ ਨਾਮ ਜਸਮੀਤ ਸਿੰਘ ਹੈ ਅਤੇ ਮੈਂ ਕੱਲ੍ਹ ਬਾਰਾਂ ਵਜੇ ਤੁਹਾਡੇ ਢਾਬੇ ਤੋਂ ਔਡਰ ਨੰਬਰ ਇਕ ਸੌ ਪੰਜ ਦਾਲ ਮੱਖਣੀ ਸ਼ਾਹੀ ਪਨੀਰ ਕੜ੍ਹੀ ਰਸ ਮਲਾਈ ਔਡਰ ਕੀਤੀ ਸੀ ਜੋ ਕਿ ਦੋ ਵਜੇ ਤੱਕ ਵੀ ਮੇਰੇ ਤੱਕ ਨਹੀਂ ਪੁਹੰਚੀ ਅਤੇ ਮੈਂ ਆਪਣੇ ਕੰਮ 'ਤੇ ਜਾਣਾ ਸੀ ਜਿਸ ਕਰਕੇ ਮੈਂ ਦੋ ਵਜੇ ਆਪਣੇ ਕੰਮ 'ਤੇ ਨਿਕਲ ਗਿਆ ਅਤੇ ਡਿਲਵਰੀ ਲੇਟ ਹੋਣ ਕਰਕੇ ਮੈਂ ਉਹ ਔਡਰ ਕੈਂਸਲ ਕਰ ਦਿੱਤਾ ਸੀ ਪਰ ਮੈਂ ਪੈਸੇ ਪਹਿਲਾਂ ਹੀ ਔਨਲਾਈਨ ਪੇਅਮੈਂਟ ਕਰ ਚੁੱਕਿਆ ਸੀ ਅਤੇ ਮੈਂ ਬਾਅਦ ਵਿੱਚ ਤੁਹਾਨੂੰ ਫੋਨ ਕੀਤਾ ਕਿ ਮੇਰੇ ਪੈਸੇ ਰੀਫੰਡ ਕੀਤੇ ਜਾਣ ਪਰ ਹੁਣ ਚੌਵੀ ਘੰਟੇ ਤੋਂ ਵੀ ਵੱਧ ਦਾ ਸਮਾਂ ਹੋ ਚੁੱਕਿਆ ਹੈ ਪਰ ਮੇਰੇ ਕੋਲ ਕੋਈ ਵੀ ਪੈਸੇ ਰੀਫੰਡ ਨਹੀਂ ਆਏ ਜੇਕਰ ਤੁਸੀਂ ਮੈਨੂੰ ਮੇਰੇ ਪੈਸੇ ਔਨਲਾਈਨ ਰੀਫੰਡ ਨਹੀਂ ਕਰ ਸਕਦੇ ਤਾਂ ਤੁਸੀਂ ਮੈਨੂੰ ਇੱਕ ਨਿਰਧਾਰਤ ਸਮਾਂ ਦੱਸ ਦੇਵੋ ਤਾਂ ਕਿ ਮੈਂ ਉਸ ਸਮੇਂ ਆ ਕੇ ਤੁਹਾਡੇ ਤੋਂ ਆਪਣੇ ਪੈਸੇ ਲੈ ਸਕਾਂ ਮੈਂ ਇਹ ਆਸ ਰੱਖਦਾ ਹਾਂ ਕਿ ਤੁਸੀਂ ਛੇਤੀ ਤੋਂ ਛੇਤੀ ਮੇਰੇ ਪੈਸੇ ਮੈਨੂੰ ਰੀਫੰਡ ਕਰ ਦੇਵੋਗੇ ਮੈਂ ਆਪ ਜੀ ਦਾ ਬਹੁਤ ਧੰਨਵਾਦੀ ਹੋਵਾਂਗਾ